ਹਾਂਜੀ ਮੈਂ ਕੁਝ ਦਿਨ ਪਹਿਲਾਂ ਫਰੀ ਇੱਦਾਂ ਹੀ ਘਰ 'ਚ ਬੈਠੀ ਹੋਈ ਸੀ ਅਤੇ ਮੈਂ ਫੋਨ ਚਲਾ ਰਹੀ ਸੀ ਅਤੇ ਮੈਂ ਇੱਕੋ ਦਮ ਮੀਸ਼ੋ ਐਪ ਖੋਲ੍ਹਿਆ ਅਤੇ ਮੀਸ਼ੋ ਐਪ ਦੇ ਵਿੱਚ ਮੈਨੂੰ ਕੁਛ ਕਾਫੀ ਵਧੀਆ ਚੀਜ਼ਾਂ ਦਿਖੀਆਂ ਜਿਸ ਦੇ ਵਿੱਚ ਇੱਕ ਬਲੈਕ ਰੰਗ ਦੀ ਜੈਕਿਟ ਸੀ ਜੋ ਕਿ ਮੈਨੂੰ ਬਹੁਤ ਹੀ ਵਧੀਆ ਲੱਗੀ ਅਤੇ ਉਸਦਾ ਪ੍ਰਾਈਜ਼ ਵੀ ਮੈਨੂੰ ਬਹੁਤ ਹੀ ਵਧੀਆ ਲੱਗਿਆ ਮੈਂ ਇਹਨੂੰ ਔਡਰ ਕਰਨ ਦੇ ਲਈ ਆਪਣਾ ਔਡਰ ਪ੍ਰੋਸੀਜਰ ਸਾਰਾ ਫਿਲ ਕਰਤਾ ਅਤੇ ਮੈਨੂੰ ਕੁਝ ਕੁ ਦਿਨਾਂ ਵਿੱਚ ਹੀ ਉਹ ਔਡਰ ਰਿਸੀਵ ਵੀ ਹੋ ਗਿਆ ਔਡਰ ਵਾਲੀ ਡੇਟ ਤੋਂ ਪਹਿਲਾਂ ਹੀ ਮੈਨੂੰ ਰਿਸੀਵ ਹੋ ਗਿਆ ਅਤੇ ਜਦੋਂ ਮੈਂ ਉਸਨੂੰ ਖੋਲ੍ਹ ਕੇ ਦੇਖਿਆ ਤਾਂ ਉਹਦਾ ਕੱਪੜਾ ਵੀ ਬਹੁਤ ਹੀ ਵਧੀਆ ਸੀ ਅਤੇ ਉਹਦਾ ਰੰਗ ਵੀ ਬਹੁਤ ਵਧੀਆ ਸੀ ਮੈਨੂੰ ਮੀਸ਼ੋ ਐਪ ਅਤੇ ਇਸ ਦੇ ਪ੍ਰੋਡਕਟ ਬਹੁਤ ਹੀ ਵਧੀਆ ਲੱਗਦੇ ਹਨ ਮੈਂ ਜਦੋਂ ਵੀ ਇਸ ਤੋਂ ਕੋਈ ਸਮਾਨ ਮੰਗਵਾਉਂਦੀ ਹਾਂ ਮੈਨੂੰ ਔਡਰ ਕੁਛ ਦਿਨ ਪਹਿਲਾਂ ਹੀ ਮਿਲ ਜਾਂਦਾ ਹੈ ਅਤੇ ਜੋ ਵੀ ਇਹਨਾਂ ਪ੍ਰੋਡਕਟ ਦੀ ਡਿਲੀਵਰੀ ਕਰਦਾ ਹੈ ਉਹਨਾਂ ਦਾ ਸੁਭਾਅ ਵੀ ਬਹੁਤ ਵਧੀਆ ਹੁੰਦਾ ਹੈ ਅਤੇ ਸਰਵਿਸ ਵੀ ਬਹੁਤ ਵਧੀਆ ਹੁੰਦੀ ਹੈ ਮੈਂ ਰਿਕੁਐਸਟ ਕਰਨਾ ਚਾਹੁੰਦੀ ਹਾਂ ਕਿ ਮੀਸ਼ੋ ਐਪ ਵਾਲੇ ਇੱਦਾਂ ਹੀ ਆਪਣੀ ਸਰਵਿਸ ਨੂੰ ਜਾਰੀ ਰੱਖਣ ਧੰਨਵਾਦ